ਘੋੜੇ ਘੋੜ ਸਵਾਰਾਂ ਦੇ ਨਾਲ ਜਿਹੜੇ ਸੰਚਾਰ ਦੀ ਗੱਲ ਹੈ ਉਹ ਇਸ ਤਰ੍ਹਾਂ ਏ ਜਿੱਦਾਂ ਘੋੜਾ ਅਤੇ ਘੋੜ ਸਵਾਰ ਦੋਨੇ ਜਦੋਂ ਤੱਕ ਤੂ ਇੱਕ ਦੂਜੇ ਨਾਲ ਮਿਲਦੇ ਜੁਲਦੇ ਨਹੀਂ ਉਦੋਂ ਤੱਕ ਇਹ ਖਤਰਾ ਹੀ ਬਣਿਆ ਰਹਿੰਦਾ ਜਦੋਂ ਘੋੜਾ ਅਤੇ ਘੋੜ ਸਵਾਰ ਇੱਕ ਦੂਜੇ ਨੂੰ ਜਾਣਦੇ ਪਹਿਚਾਣਦੇ ਨਹੀਂ ਤਾਂ ਇਹ ਵੱਡੀ ਸਮੱਸਿਆ ਦਾ ਕਾਰਨ ਵੀ ਬਣਦੇ ਨੇ ਅਤੇ ਜਿਹੜੇ ਇਹਨਾਂ ਦੇ ਸੰਕੇਤ ਨੇ ਉਹ ਇਹ ਹੁੰਦੇ ਨੇ ਜਦੋਂ ਘੋੜਾ ਬਿਮਾਰ ਹੋ ਜਾਵੇ ਅਤੇ ਘੋੜ ਸਵਾਰ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਜਿਹੜੀ ਹਰਕਤ ਕਰ ਰਿਹਾ ਇਹ ਕਿਸ ਚੀਜ਼ ਦੀ ਹਰਕਤ ਹੈ ਕਿਹੜੀ ਬਿਮਾਰੀ ਹੋ ਗਈ ਇਹਨੂੰ ਕੀ ਪ੍ਰੋਬਲਮ ਆ ਗਈ ਅਤੇ ਜਦੋਂ ਮੰਨ ਲਉ ਸਪੋਜ ਕਰੋ ਕਈ ਵਾਰੀ ਗਰਮੀਆਂ ਦੇ ਮੌਸਮ ਦੇ ਵਿੱਚ ਇਹਨਾਂ ਦੇ ਤਬੇਲਿਆਂ ਦੇ ਵਿੱਚ ਜਿਵੇਂ ਮੰਨ ਲਉ ਕੋਈ ਚੀਜ਼ ਨੇੜੇ ਆ ਜਾਂਦੀ ਆ ਸੱਪ ਆ ਜਾਂਦਾ ਜਾਂ ਕੋਈ ਹੋਰ ਆ ਜਾਂਦਾ ਤਾਂ ਇਹ ਆਪਣੀ ਹਰਕਤ ਚੇਂਜ ਕਰ ਦਿੰਦੇ ਨੇ ਬੋਲਦੇ ਨੇ ਅਤੇ ਉਹ ਘੋੜ ਸਵਾਰ ਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਆ ਇਹ ਸੰਕੇਤ ਦਿੰਦੇ ਨੇ